ਹਾਂਜੀ ਬਿਜਲੀ ਦੇ ਖਤਰੇ ਬਿਜਲੀ ਦੇ ਖਤਰਿਆਂ ਤੋਂ ਮੈਂ ਬਿਲਕੁਲ ਜਾਣੂ ਹਾਂ ਬਿਜਲੀ ਬਹੁਤ ਸਾਰੇ ਲੋਕਾਂ ਨੂੰ ਮੈਂ ਕਰੰਟ ਲੱਗਦੇ ਦੇਖਿਆ ਹੈ ਕਿ ਉਹਨਾਂ ਦੀ ਡੈਥ ਵੀ ਹੁੰਦੀ ਦੇਖੀ ਹੈ ਜਾਂ ਝੱਟਕੇ ਲੱਗ ਜਾਂਦੇ ਨੇ ਠੀਕ ਹੈ ਤਾਂ ਓਹ ਕਿਤੇ ਨਾ ਕਿਤੇ ਸਾਡੀ ਹੀ ਲਾਪਰਵਾਹੀ ਕਾਰਨ ਹੁੰਦੇ ਆ ਬਿਜਲੀ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਵਾਰ ਵਾਇਰਿੰਗ ਪਲੱਗ ਨਹੀਂ ਅਸੀਂ ਲਗਾਉਂਦੇ ਠੀਕ ਹੈ ਤਾਂ ਉਹ ਡੀਰੈਕਟ ਲਗਾ ਰਹੇ ਹੁੰਦੇ ਹਾਂ ਤਾਰਾਂ ਉੱਥੋਂ ਝੱਟਕੇ ਦਾ ਇੱਕ ਮਤਲਬ ਕਾਫੀ ਚਾਂਸ ਹੁੰਦੇ ਹੈ ਕਿ ਉੱਥੇ ਝੱਟਕਾ ਲੱਗ ਸਕਦਾ ਜਾਂ ਫਿਰ ਵਾਇਰਿੰਗ ਪ੍ਰੋਪਰ ਨਹੀਂ ਹੋਈ ਹੁੰਦੀ ਉਹਨੂੰ ਟੇਪ ਨਹੀਂ ਕੀਤਾ ਹੁੰਦਾ ਨੰਗੀਆਂ ਹੀ ਤਾਰਾਂ ਪਈਆਂ ਹੁੰਦੀਆਂ ਉਹਦੇ ਕਾਰਨ ਬਿਜਲੀ ਦੇ ਝੱਟਕੇ ਆਉਂਦੇ ਹੈ ਜਾਂ ਫਿਰ ਕਿਤੇ ਨਾ ਕਿਤੇ ਇੱਕ ਪ੍ਰੋਪਰ ਅਰਥ ਨਹੀਂ ਕੀਤਾ ਹੁੰਦਾ ਉਹ ਇੱਕ ਕਾਰਨ ਬਣ ਜਾਂਦਾ ਗਿੱਲੇ ਹੱਥ ਲਗਾ ਕੇ ਅਸੀਂ ਮਤਲਬ ਤਾਰਾਂ ਲੱਗਦਿਆਂ ਫੂ ਮਤਲਬ ਪੈਰ ਵੀ ਸਾਡੇ ਨੰਗੇ ਹੁੰਦੇ ਆ ਹੱਥ ਗਿੱਲੇ ਹੁੰਦੇ ਆ ਜਿਹਦੇ ਕਰਕੇ ਬੌਡੀ ਦੇ ਵਿੱਚ ਦੀ ਸਰੀਰ ਦੇ ਵਿੱਚ ਦੀ ਕਰੰਟ ਲੰਘ ਜਾਂਦਾ ਉਹ ਇੱਕ ਬਿਜਲੀ ਦੇ ਮਤਲਬ ਕਰੰਟ ਦਾ ਮੇਨ ਖਤਰਾ ਹੁੰਦਾ ਹੈ ਜਾਂ ਫਿਰ ਦੇਖਦੇ ਹਾਂ ਕਿ ਬਹੁਤ ਟਰੱਕ ਵਗੈਰਾ ਜਾ ਰਹੇ ਆ ਕਿਸੇ ਗਲੀ ਦੇ ਵਿੱਚ ਤਾਂ ਉਹ ਤਾਰਾਂ ਨੂੰ ਸਿੱਟ ਜਾਂਦੇ ਨੇ ਤੋੜ ਜਾਂਦੇ ਨੇ ਅਤੇ ਉਸ ਤੋਂ ਬਾਅਦ ਕਾਫੀ ਕਾਫੀ ਟਾਈਮ ਲੰਬੇ ਟਾਈਮ ਤੱਕ ਉਸਦਾ ਕੋਈ ਦੁਬਾਰਾ ਪ੍ਰੋਪਰ ਮੈਨੇਜ ਨਹੀਂ ਕੀਤਾ ਜਾਂਦਾ ਉਹ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ ਜਾਂ ਉੱਥੋਂ ਦੇ ਸਰਪੰਚ ਜਾਂ ਫਿਰ ਮਿਊਂਸੀਪਲ ਕਮੇਟੀ ਜੋ ਵੀ ਹੈ ਉਹਨਾਂ ਨੂੰ ਨਹੀਂ ਦੇਖਦੀ ਤਾਂ ਉਹ ਟਰੱਕ ਵਗੈਰਾ ਇੱਦਾਂ ਹੀ ਲੰਘ ਜਾਂਦੇ ਨੇ ਤਾਰਾਂ ਨੂੰ ਤੋੜ ਕੇ ਤਾਂ ਉਹ ਲਗਾਤਾਰ ਖਤਰਿਆਂ ਦਾ ਕਾਰਨ ਬਣਿਆ ਰਹਿੰਦਾ ਹੈ ਇਸ ਤੋਂ ਬਿਨਾਂ ਇਸਦੇ ਕਾਫੀ ਸਾਰੇ ਬਚਾਅ ਨੇ ਜਿਵੇਂ ਕਿ ਜਦੋਂ ਵੀ ਜੇਕਰ ਘਰ ਵੀ ਲਟਕ ਰਿਹਾ ਕਿਤੇ ਨੰਗੀ ਤਾਰ ਮਿਲ ਰਹੀ ਆ ਉਹਨੂੰ ਪ੍ਰੋਪਰ ਵਾਇਰ ਨੂੰ ਪ੍ਰੋਪਰ ਸੀਲ ਕਰ ਦਿੱਤਾ ਜਾਵੇ ਉਹਦੇ ਉੱਪਰ ਟੇਪ ਵਗੈਰਾ ਜਾਵੇ ਜਿੰਨਾਂ ਹੋ ਸਕੇ ਬਿਜਲੀ ਨੂੰ ਘਰ ਬਣਾਉਣ ਟਾਈਮ ਅੰਡਰ ਵੋਲ ਹੀ ਹੋਵੇ ਮਤਲਬ ਕੰਧ ਦੇ ਵਿੱਚ ਦੀ ਹੀ ਉਹਨੂੰ ਤਾਰਾਂ ਵਗੈਰਾ ਰੱਖੀਆਂ ਜਾਣ ਤਾਂ ਜਿਹੜੇ ਡਰੈਕਟ ਅਸੀਂ ਯੂਸ ਕਰ ਰਹੇ ਹਾਂ ਜਿਵੇਂ ਕਿ ਰੋਡ ਹੈ ਹੀਟਰ ਇਹਨਾਂ ਨੂੰ ਥੋੜ੍ਹੇ ਬੱਚਿਆਂ ਤੋਂ ਵੀ ਜ਼ਿਆਦਾ ਦੂਰ ਹੀ ਰੱਖਿਆ ਜਾਵੇ ਕਿਉਂਕਿ ਉਹਨਾਂ ਦਾ ਵੀ ਖਤਰਾ ਹੁੰਦਾ ਕਿ ਖੇਲਦੇ ਖੇਲਦੇ ਆ ਕੇ ਉੱਥੇ ਉਹ ਹੱਥ ਲਗਾ ਲੈਣ ਤਾਂ ਉਹ ਵੀ ਇੱਕ ਪ੍ਰੋਬਲਮ ਹੈ ਠੀਕ ਹੈ ਅਤੇ ਇਹ ਜਿੱਦਾਂ ਵੀ ਬਿਜਲੀ ਦੇ ਨਾਲ ਰਿਲੇਟਡ ਪ੍ਰੋਬਲਮਸ ਨੇ ਬੱਚਿਆਂ ਨੂੰ ਖਾਸ ਕਰਕੇ ਜਾਂ ਫਿਰ ਸਾਨੂੰ ਵੀ ਆਪਣੇ ਹੱਥ ਵਗੈਰਾ ਜਾਂ ਫੁੱਟਵੀਅਰ ਪਾ ਕੇ ਹੀ ਉਹਨਾਂ ਨੂੰ ਧਿਆਨ ਦੇ ਨਾਲ ਔਪਰੇਟ ਕਰਨਾ ਚਾਹੀਦਾ ਜਾਂ ਫਿਰ ਜਿੰਨੀਆਂ ਵੀ ਕੋਈ ਸੜੀ ਹੋਈ ਆ ਜਾਂ ਕਿਤੋਂ ਵਾਇਰ ਵਗੈਰਾ ਕ੍ਰੈਕ ਹੈ ਉਹ ਸਭ ਦਾ ਧਿਆਨ ਰੱਖਣਾ ਚਾਹੀਦਾ ਉਹਨੂੰ ਪ੍ਰੋਪਰ ਸੀਲ ਕਰ ਲੈਣਾ ਚਾਹੀਦਾ ਇਹੀ ਇਹਦੇ ਬਚਣ ਦੇ ਉਪਾਅ ਹੈ ਬਾਕੀ ਆਪਣਾ ਬਚਾਅ ਆਪ ਹੀ ਕਰਨਾ ਪੈਂਦਾ ਹੈ